ਹੈਲੋ ਮੈਂ ਪਟਿਆਲਾ ਤੋਂ ਪ੍ਰਭਜੋਤ ਕੌਰ ਬੋਲ ਰਹੀ ਹਾਂ ਮੈਂ ਆਪ ਜੀ ਨੂੰ ਇੱਕ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੀ ਹਾਂ ਮੈਂ ਕੱਲ੍ਹ ਆਪ ਜੀ ਦੇ ਰੈਸਟੋਰੈਂਟ ਤੋਂ ਇੱਕ ਕੇਕ ਔਡਰ ਕੀਤਾ ਸੀ ਜੋ ਕਿ ਇੱਕ ਜਨਮ ਦਿਨ ਕੇਕ ਸੀ ਪਰੰਤੂ ਮੈਂ ਕੱਲ੍ਹ ਰਾਤ ਐਨੀਵਰਸਰੀ ਕੇਕ ਪ੍ਰਾਪਤ ਕੀਤਾ ਫੰਕਸ਼ਨ ਟਾਈਮ ਜਦੋਂ ਅਸੀਂ ਕੇਕ ਖੋਲ੍ਹਿਆ ਤਾਂ ਸਾਨੂੰ ਪਤਾ ਲੱਗਾ ਕਿ ਇਹ ਇੱਕ ਕੇਕ ਕਿਸੇ ਹੋਰ ਦਾ ਹੈ ਇਸ ਕਾਰਨ ਸਾਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਅਤੇ ਘਰ ਵਿੱਚ ਸਭ ਦਾ ਮੂਡ ਔਫ ਹੋ ਗਿਆ ਫਿਰ ਮੈਂ ਆਪ ਜਾ ਕੇ ਬਜ਼ਾਰ ਤੋਂ ਇੱਕ ਹੋਰ ਕੇਕ ਲੈ ਕੇ ਆਈ ਇਸ ਨਾਲ ਮੇਰਾ ਟਾਈਮ ਵੀ ਖਰਾਬ ਹੋਇਆ ਇਸ ਲਈ ਮੈਂ ਆਪ ਜੀ ਦੀ ਕੰਪਨੀ ਦੇ ਡਿਲੀਵਰੀ ਡਿਪਾਟਮੈਂਟ ਸੰਬੰਧੀ ਸ਼ਿਕਾਇਤ ਦਰਜ ਕਰਨਾ ਚਾਹੁੰਦੀ ਹਾਂ ਅਤੇ ਦੱਸਣਾ ਚਾਹੁੰਦੀ ਹਾਂ ਕਿ ਆਪ ਜੀ ਦੀ ਕੰਪਨੀ ਦੀ ਡਿਲੀਵਰੀ ਸੁਵਿਧਾ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀ ਕਿਰਪਾ ਕਰਕੇ ਇਸ ਵੱਲ ਧਿਆਨ ਦਿੱਤਾ ਜਾਵੇ ਅਤੇ ਨਾਲ ਹੀ ਮੈਂ ਆਪ ਜੀ ਤੋਂ ਰੀਫੰਡ ਦੀ ਉਮੀਦ ਵੀ ਕਰਦੀ ਹਾਂ ਕਿ ਤੁਸੀਂ ਮੈਨੂੰ ਮੇਰੀ ਰਕਮ ਵਾਪਿਸ ਕਰੋਗੇ ਅਤੇ ਇਸ ਮੁਸ਼ਕਿਲ ਦਾ ਹੱਲ ਜਲਦੀ ਤੋਂ ਜਲਦੀ ਕੱਢੋਗੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਹੋਰ ਨੂੰ ਇਹੋ ਜਿਹੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ